ਇਲਾਕੇ ਦੇ ਲੋਕ ਬਹੁਤ ਸਾਰੇ ਵਹਿਮਾਂ ਭਰਮਾਂ ਦੇ ਸ਼ਿਕਾਰ ਹਨ ਜਿਵੇਂ ਬਿੱਲੀ ਦਾ ਰਸਤਾ ਕੱਟ ਜਾਣਾ ਜਾਂ ਕਿਸੇ ਥਾਂ ਨੂੰ ਚੱਲਣ ਲੱਗਿਆਂ ਖਾਲੀ ਟੋਕਰੇ ਵਾਲਾ ਵਿਅਕਤੀ ਮਿਲ ਜਾਣਾ ਇਸ ਤੋਂ ਇਹ ਵਹਿਮ ਕੀਤਾ ਜਾਂਦਾ ਹੈ ਕਿ ਜਿਹੜੇ ਵੀ ਤੁਸੀਂ ਕੰਮ ਨੂੰ ਜਾ ਰਹੇ ਹੋ ਉਹ ਕੰਮ ਸਿਰੇ ਨਹੀਂ ਚੜ੍ਹੇਗਾ ਇਸੇ ਤਰ੍ਹਾਂ ਜਾਂ ਕੋਈ ਕੰਮ ਨਵਾਂ ਸ਼ੁਰੂ ਕਰਨ ਲੱਗਿਆਂ ਜਾਂ ਕਿਤੇ ਨੂੰ ਜਾਣ ਲੱਗਿਆਂ ਵੀ ਜੇਕਰ ਕੋਈ ਵਿਅਕਤੀ ਛਿੱਕ ਮਾਰ ਦੇਵੇ ਤਾਂ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਜਿਹੜਾ ਕੰਮ ਹੈ ਇਹ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹੇਗਾ ਇਸੇ ਤਰ੍ਹਾਂ ਕਈ ਦਿਨਾਂ ਦਾ ਵੀ ਵਿਚਾਰ ਕੀਤਾ ਜਾਂਦਾ ਹੈ ਜਿਵੇਂ ਕਿ ਮੰਗਲਵਾਰ ਵੀਰਵਾਰ ਸ਼ਨੀਵਾਰ ਆਦਿ ਨੂੰ ਕੱਪੜੇ ਨਹੀਂ ਧੋਂਦੇ ਲੋਕ ਬਹੁਤ ਸਾਰੇ ਮੀਟ ਸ਼ਰਾਬ ਦਾ ਸੇਵਨ ਨਹੀਂ ਕਰਦੇ ਨਾਈ ਤੋਂ ਬਾਲ ਵਗੈਰਾ ਨਹੀਂ ਕਟਾਉਂਦੇ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਵਹਿਮ ਭਰਮ ਕੀਤੇ ਜਾਂਦੇ ਹਨ ਜੋ ਏ ਮੇਰੇ ਹਿਸਾਬ ਨਾਲ ਅੱਜ ਦੇ ਸਾਇੰਸ ਯੁੱਗ ਵਿੱਚ ਠੀਕ ਨਹੀਂ ਹੈ ਕਿਉਂਕਿ ਜੋ ਵੀ ਪਰਮਾਤਮਾ ਨੇ ਦਿਨ ਬਣਾਏ ਹੈ ਉਹ ਸਾਰੇ ਬਰਾਬਰ ਹਨ ਇਹਨਾਂ ਵਹਿਮਾਂ ਭਰਮਾਂ ਦਾ ਸ਼ਿਕਾਰ ਨਹੀਂ ਸਾਨੂੰ ਹੋਣਾ ਚਾਹੀਦਾ ਅਤੇ